ਮੈਨੂੰ ਛੋਟੀ ਹੁੰਦੀ ਤੋਂ ਹੀ ਡਾਂਸ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਅਤੇ ਡਾਂਸ ਸਿੱਖਣ ਦੀ ਇੱਛਾ ਵੀ ਮੇਰੇ ਮਨ ਵਿੱਚ ਬਹੁਤ ਸੀ ਡਾਂਸ ਸਿੱਖਣ ਦੀ ਇੱਛਾ ਨੂੰ ਦੇਖਦੇ ਹੋਏ ਮੇਰੇ ਘਰਦਿਆਂ ਨੇ ਮੈਨੂੰ ਮਤਲਬ ਮੇਰੇ ਪਾਪਾ ਨੇ ਮੈਨੂੰ ਡਾਂਸ ਸਿੱਖਣ ਦੇ ਲਈ ਡਾਂਸ ਅਕੈਡਮੀ ਦੇ ਵਿੱਚ ਲਗਾ ਦਿੱਤਾ ਡਾਂਸ ਅਕੈਡਮੀ ਵਿੱਚ ਲੱਗਣ ਦੇ ਨਾਲ ਕਿਆ ਏ ਮੈਂ ਆਪਣੇ ਜਿਹੜਾ ਡਾਂਸ ਹੈ ਉਹਨੂੰ ਹੋਰ ਜ਼ਿਆਦਾ ਆ ਵਧੀਆ ਢੰਗ ਦੇ ਨਾਲ ਮਤਲਬ ਸਿੱਖਿਆ ਅਤੇ ਵਧੀਆ ਵਧੀਆ ਸਟੈਪ ਸਿੱਖੇ ਜਿਸ ਦੇ ਨਾਲ ਕਿਹਾ ਮੈਂ ਬਹੁਤ ਜ਼ਿਆਦਾ ਵਧੀਆ ਮਤਲਬ ਮੈਨੂੰ ਗਿੱਧਾ ਪਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਡਾਂਸ ਦੇ ਵਿੱਚ ਮੈਨੂੰ ਗਿੱਧਾ ਪਾਉਣ ਦਾ ਬਹੁਤ ਜ਼ਿਆਦਾ ਸ਼ੌਂਕ ਸੀ ਜਿਸ ਦੇ ਕਰਕੇ ਮੈਂ ਗਿੱਧੇ ਦੇ ਵਿੱਚ ਐਨ ਵਧੀਆ ਮਤਲਬ ਵਧੀਆ ਹੋ ਗਈ ਅਤੇ ਜਦੋਂ ਮੈਂ ਆਪਣੇ ਕਾਲਜ ਦੇ ਵਿੱਚ ਆਈ ਅਤੇ ਕਾਲਜ ਦੇ ਵਿੱਚ ਆਉਣ ਦੇ ਨਾਲ ਮੈਂ ਕਿਹਾ ਕਿ ਮੈਂ ਜੋ ਯੂਥ ਗੇਮਸ ਹੁੰਦੀਆਂ ਯੂਥ ਹੁੰਦੇ ਆ ਯੂਥ ਮੇਲੇ ਹੁੰਦੇ ਆ ਮੈਂ ਉਹਨਾਂ ਵਿੱਚ ਪਾਰਟ ਲੈਣ ਲੱਗੀ ਯੂਥ ਉਹਨਾਂ ਮੇਲਿਆਂ ਦੇ ਵਿੱਚ ਪਾਰਟ ਲੈਣ ਦੇ ਨਾਲ ਮੇਰਾ ਕਿਆ ਹੈ ਜੋ ਗਿੱਧਾ ਏ ਗਿੱਧੇ ਦੀ ਜਿਹੜਾ ਮੇਰਾ ਹੁਨਰ ਹੈ ਇਹ ਹੋਰ ਜ਼ਿਆਦਾ ਵਧੀਆ ਹੋ ਗਿਆ ਅਤੇ ਜਦੋਂ ਮੈਂ ਕਾਲਜ ਦੇ ਵਿੱਚ ਆਈ ਕਾਲਜ ਦੇ ਵਿੱਚ ਆਉਣ ਦੇ ਨਾਲ ਮੈਨੂੰ ਹੋਰ ਵਧੀਆ ਗਿੱਧੇ ਦੇ ਟੀਚਰਸ ਮਿਲੇ ਗਿੱਧੇ ਦੇ ਵਧੀਆ ਟੀਚਰਸ ਮਿਲਣ ਦੇ ਕਰਕੇ ਮੈਂ ਆਪਣੇ ਹੋਰ ਜਿਹੜੀਆਂ ਕਮੀਆਂ ਪੇਸ਼ੀਆਂ ਸੀਗੀਆਂ ਉਹਨਾਂ ਨੂੰ ਹੋਰ ਸੁਧਾਰਿਆ ਅਤੇ ਮੈਂ ਜਦੋਂ ਆਪਣੇ ਜੋ ਮੇਰਾ ਇਹਨਾਂ ਨੂੰ ਵਧਾਉਣ ਦੇ ਨਾਲ ਮੈਂ ਹੋਰ ਵਧੀਆ ਕੀਤਾ ਅਤੇ ਜਦੋਂ ਮੇਰਾ ਯੂਥ ਫੈਸਟੀਵਲ ਹੋਇਆ ਯੂਥ ਫੈਸਟੀਵਲ ਦੇ ਵਿੱਚ ਮੈਂ ਪਾਰਟ ਲਿਆ ਦੋ ਹਜ਼ਾਰ ਬਾਈ ਵਾਲੇ ਯੂਥ ਫੈਸਟੀਵਲ ਦੇ ਵਿੱਚ ਮੈਂ ਪਾਰਟ ਲਿਆ ਜਦੋਂ ਮੈਂ ਯੂਥ ਫੈਸਟੀਵਲ ਦੇ ਵਿੱਚ ਪਾਰਟ ਲਿਆ ਪਹਿਲਾਂ ਪਹਿਲਾਂ ਸਾਡੇ ਕਾਲਜ ਦੇ ਵਿੱਚ ਹੀ ਸਿਖਾਉਂਦੇ ਹੁੰਦੇ ਸੀ ਮੈਂ ਇੱਕ ਮਹੀਨਾ ਕਾਲਜ ਦੇ ਵਿੱਚ ਜਦੋਂ ਸਾਡੀ ਪੂਰੀ ਟੀਮ ਪ੍ਰੈਕਟਿਸ ਕਰਦੀ ਹੁੰਦੀ ਸੀ ਅਸੀਂ ਸਟੈਪ ਮੈਚ ਕਰਨੇ ਸਾਡੀ ਮੈਡਮ ਨੇ ਸਾਨੂੰ ਸਟੈਪ ਸਿਖਾਉਣੇ ਕਿ ਕਿੱਦਾਂ ਕਰਨਾ ਕਿੱਦਾਂ ਨਹੀਂ ਕਰਨਾ ਕਿੱਦਾਂ ਬੋਲੀਆਂ ਪਾਉਣੀਆਂ ਕਿੱਦਾਂ ਨਹੀਂ ਕਰਨੀਆਂ ਅਤੇ ਉਹ ਦਿਨ ਮੇਰੇ ਦਿਨ ਮਤਲਬ ਉਹ ਦਿਨ ਜਿਸ ਦਿਨ ਸਾਡਾ ਯੂਥ ਫੈਸਟੀਵਲ ਸੀ ਸਭ ਸਾਡੀ ਪੂਰੀ ਟੀਮ ਦੀਆਂ ਧੜਕਣਾਂ ਬਹੁਤ ਜ਼ਿਆਦਾ ਤੇਜ਼ ਸੀਗੀਆਂ ਅਤੇ ਜਿਹੜਾ ਉਹ ਸਮਾਗਮ ਸੀਗਾ ਉਹ ਯੂਥ ਫੈਸਟੀਵਲ ਸੀਗਾ ਸਾਡਾ ਉਹ ਸਾਡਾ ਯਾਦਗਾਰੀ ਯੂਥ ਫੈਸਟੀਵਲ ਸੀਗਾ ਕਿਉਂਕਿ ਉਸ ਵਾਰ ਸਾਡੀ ਕਾਲਜ ਦੀ ਗਿੱਧੇ ਦੇ ਵਿੱਚ ਟਰੋਫੀ ਆਈ ਸੀਗੀ ਸਾਡੀ ਜਿਹੜੀ ਪੂਰੀ ਟੀਮ ਹੈ ਇਹਨੇ ਬਹੁਤ ਜ਼ਿਆਦਾ ਵਧੀਆ ਪਰਫੋਰਮੈਂਸ ਕੀਤਾ ਸੀਗਾ ਅਤੇ ਸਾਡੀ ਇਹ ਵਧੀਆ ਪਰਫੋਰਮੈਂਸ ਆ ਇੱਕੋ ਇੱਕ ਕਾਰਨ ਸੀ ਕਿ ਅਸੀਂ ਪੂਰੀ ਟੀਮ ਨੇ ਹੀ ਬਹੁਤ ਜ਼ਿਆਦਾ ਮਿਹਨਤ ਕੀਤੀ ਸੀ ਪੂਰੀ ਟੀਮ ਦੀ ਮਿਹਨਤ ਦੇ ਨਾਲ ਨਾਲ ਸਾਡੀ ਮੈਡਮ ਦੀ ਜੋ ਸਾਨੂੰ ਗਿੱਧਾ ਸਿਖਾਉਂਦੀ ਸੀ ਉਸ ਦੀ ਵੀ ਬਹੁਤ ਜ਼ਿਆਦਾ ਮਿਹਨਤ ਸੀ ਕਿਉਂਕਿ ਜੋ ਸਾਰੇ ਸਟੈਪ ਸੀਗੇ ਇਹ ਸਾਨੂੰ ਸਭ ਨੂੰ ਹੀ ਸਾਡੀ ਪੂਰੀ ਟੀਮ ਨੂੰ ਹੀ ਪਹਿਲਾਂ ਤੋਂ ਹੀ ਗਿੱਧਾ ਕਰਨਾ ਆਉਂਦਾ ਸੀ ਸਭ ਨੂੰ ਹੀ ਆਉਂਦਾ ਸੀ ਅਤੇ ਜਿਹੜੇ ਸਾਡੇ ਸਟੈਪਾਂ ਦੇ ਵਿੱਚ ਜਿਹੜੇ ਸਾਡੇ ਗਿੱਧੇ ਦੇ ਵਿੱਚ ਹੋਰ ਵਧੀਆ ਮੈਡਮ ਨੇ ਸੁਧਾਰ ਕੀਤੇ ਅਤੇ ਸਾਨੂੰ ਇੱਕੋ ਟਿਊਨ ਦੇ ਵਿੱਚ ਗਿੱਧੇ ਦੇ ਸਟੈਪ ਕਰਵਾਏ ਬਹੁਤ ਮਿਹਨਤ ਕਰਵਾਈ ਸਾਡੀ ਮੈਡਮ ਨੇ ਸਾਨੂੰ ਜਿਸ ਦੇ ਨਾਲ ਕਿਆ ਏ ਅਸੀਂ ਇੱਕ ਵਧੀਆ ਮਤਲਬ ਗਿੱਧੇ ਦੀ ਪੇਸ਼ਕਸ਼ ਕੀਤੀ ਪਹਿਲਾਂ ਸਾਡਾ ਮਤਲਬ ਜਦੋਂ ਅਸ ਅਸੀਂ ਯੂਥ ਫੈਸਟੀਵਲ ਦੇ ਵਿੱਚ ਜਾਣ ਤੋਂ ਪਹਿਲਾਂ ਜਿੱਦਾਂ ਕਿ ਅਸੀਂ ਇੱਕ ਦੋ ਹਫਤਾ ਪ੍ਰੈਕਟਿਸ ਕੀਤੀ ਇੱਕ ਦੋ ਹਫਤਾ ਪ੍ਰੈਕਟਿਸ ਕਰਨ ਤੋਂ ਬਾਅਦ ਅਸੀਂ ਕਾਲਜ ਦੇ ਵਿੱਚ ਹੀ ਆਪਣਾ ਜੋ ਗਿੱਧਾ ਹੈ ਉਹ ਪੇਸ਼ ਕੀਤਾ ਅਤੇ ਪ੍ਰਿੰਸੀਪਲ ਸੀਗੀ ਉੱਥੇ ਪੂਰਾ ਸਟਾਫ ਸੀਗਾ ਸਟਾਫ ਸੀਗਾ ਟੀਚਰਾਂ ਦਾ ਅਤੇ ਉਹਨਾਂ ਨੇ ਸਾਡਾ ਗਿੱਧਾ ਦੇਖਿਆ ਅਤੇ ਉਹਨਾਂ ਨੇ ਸਾਡੇ ਵਿੱਚ ਕਾਫੀ ਕਮੀਆਂ ਪੇਸ਼ੀਆਂ ਕੱਢੀਆਂ ਕਿਉਂਕਿ ਹਾਲੇ ਯੂਥ ਫੈਸਟੀਵਲ ਨੂੰ ਵੀ ਦੋ ਹਫਤੇ ਬਾਕੀ ਸੀਗੇ ਜਾ ਯੂਥ ਫੈਸਟੀਵਲ ਦੋ ਹਫਤੇ ਬਾਕੀ ਸੀਗੇ ਅਤੇ ਸਾਡੀ ਮੈਡਮ ਨੇ ਸਾਡੇ ਵਿੱਚ ਹੋਰ ਸੁਧਾਰ ਲਿਆਉਂਦੇ ਉਹਨਾਂ ਸੁਧਾਰਾਂ ਦੇ ਇਹ ਕਾਰਨ ਸਾਡਾ ਜਿਹੜਾ ਜਿਹੜਾ ਫਾਈਨਲ ਯੂਥ ਫੈਸਟੀਵਲ ਵਾਲਾ ਦਿਨ ਸੀਗਾ ਉਹ ਬਹੁਤ ਜ਼ਿਆਦਾ ਵਧੀਆ ਅਤੇ ਬਹੁਤ ਜ਼ਿਆਦਾ ਹੀ ਐਕਸਾਈਟਡ ਡੇਅ ਸੀਗਾ ਸਾਡਾ ਅਤੇ ਉਸ ਦਿਨ ਅਸੀਂ ਬਹੁਤ ਮੌਜ ਮਸਤੀ ਕੀਤੀ ਸਾਡੀ ਪੂਰੀ ਟੀਮ ਨੇ ਰੱਜ ਕੇ ਗਿੱਧਾ ਪਾਇਆ ਰੱਜ ਕੇ ਬਾਅਦ ਵਿੱਚ ਜਦੋਂ ਸਾਡੇ ਹੱਥ ਵਿੱਚ ਟਰੋਫੀ ਆਈ ਅਸੀਂ ਰੱਜ ਕੇ ਭੰਗੜਾ ਪਾਇਆ ਪੂਰੇ ਨੱਚਦੇ ਟੱਪਦੇ ਅਸੀਂ ਆਪਣੇ ਕਾਲਜ ਨੂੰ ਵਾਪਿਸ ਆਏ ਇਹ ਸਾਡਾ ਜਿਹੜਾ ਦਿਨ ਸੀਗਾ ਇਹ ਸਾਨੂੰ ਹਮੇਸ਼ਾ ਯਾਦਗਾਰ ਰਹਿਣਾ ਹੈ ਹਮੇਸ਼ਾ ਯਾਦ ਰਹਿਣਾ ਹੈ ਜਦੋਂ ਸਾਡੇ ਹੱਥਾਂ ਦੇ ਵਿੱਚ ਟਰੋਫੀ ਆਈ ਸੀ ਸਾਡੀ ਟੀਮ ਦੀ ਪੁਜ਼ੀਸ਼ਨ ਆਈ ਸੀ ਸਾਡੇ ਕਾਲਜ ਦਾ ਨਾਮ ਅਨਾਊਂਸ ਹੋਇਆ ਸੀ ਕਿ ਗਿੱਧੇ ਦੀ ਇਹ ਕਾਲਜ ਫਸਟ ਆਈ ਹੈ ਟੀਮ ਇਹ ਸਾਨੂੰ ਸਾਡੀ ਪੂਰੀ ਟੀਮ ਨੂੰ ਇਹ ਦਿਨ ਨਹੀਂ ਭੁੱਲੇਗਾ ਅਤੇ ਸਾਡੀ ਮੈਡਮ ਜੋ ਸਾਨੂੰ ਗਿੱਧਾ ਸਿਖਾਉਂਦੀ ਸੀ ਉਹਦੀ ਮਿਹਨਤ ਵੀ ਸਫਲ ਹੋਈ ਉਹ ਵੀ ਬਹੁਤ ਖੁਸ਼ ਸੀ ਉਹਨੇ ਸਾਨੂੰ ਸ਼ਾਬਾਸ਼ੀ ਦਿੱਤੀ ਅਤੇ ਇਹ ਦਿਨ ਸਾਡਾ ਜਿਹੜਾ ਦਿਨ ਹੈ ਇਹ ਸਾਡੇ ਲਈ ਬਹੁਤ ਜ਼ਿਆਦਾ ਯਾਦਗਾਰ ਬਣ ਗਿਆ ਅਤੇ ਜਦੋਂ ਇਹ ਇਹ ਅਸੀਂ ਆਪਣੀ ਟਰੋਫੀ ਲੈ ਕੇ ਆਪਣੇ ਕਾਲਜ ਆਏ ਕਾਲਜ ਆ ਕੇ ਅਸੀਂ ਇਹ ਟਰੋਫੀ ਆਪਣੇ ਪ੍ਰਿੰਸੀਪਲ ਨੂੰ ਦਿੱਤੀ ਅਤੇ ਉਹ ਵੀ ਬਹੁਤ ਖੁਸ਼ ਹੋਇਆ ਅਸੀਂ ਨੱਚਦੇ ਟੱਪਦੇ ਅਤੇ ਇਹ ਸਾਡੀ ਪੂਰੀ ਟੀਮ ਨੂੰ ਇਹ ਜਿਹੜਾ ਦਿਨ ਹੈ ਯੂਥ ਫੈਸਟੀਵਲ ਵਾਲਾ ਸਾਡੀ ਟੀਮ ਦੀ ਪੁਜੀਸ਼ਨ ਆਉਣ ਵਾਲਾ ਇਹ ਸਾਡਾ ਦਿਨ ਸਾਡੀ ਪੂਰੀ ਟੀਮ ਨੂੰ ਮੈਨੂੰ ਬਹੁਤ ਜ਼ਿਆਦਾ ਹੀ ਮਤਲਬ ਮੈਨੂੰ ਕਦੇ ਨਹੀਂ ਭੁੱਲੇਗਾ ਇਹ ਦਿਨ ਅਤੇ ਇਸ ਦਿਨ ਦੀ ਜਿਹੜੀ ਕੀਤੀ ਮੌਜ ਮਸਤੀ ਹੈ ਇਹ ਕਦੇ ਵੀ ਮਤਲਬ ਮੈਨੂੰ ਆਪਣੀ ਲਾਈਫ ਦੇ ਵਿੱਚ ਮੈਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਭੁੱਲੀ ਭੁੱਲ ਸਕਦੀ ਮੈਂ